ਹੈਲੋ ਸਤਿ ਸ਼੍ਰੀ ਅਕਾਲ ਜੀ ਮੈਮ ਮੈਂ ਨਾ ਰੋਪੜ ਤੋਂ ਸੀ ਅਤੇ ਤੁਸੀਂ ਪਟਿਆਲੇ ਤੋਂ ਠੀਕ ਹੈ ਮੈਨੂੰ ਨਾ ਤੁਹਾਡਾ ਨੰਬਰ ਮੇਰੇ ਕਿਸੇ ਫ੍ਰੇਂਡ ਤੋਂ ਮਿਲਿਆ ਸੀਗਾ ਅਤੇ ਅਸੀਂ ਨਾ ਰੋਪੜ ਤੋਂ ਪਟਿਆਲਾ ਘੁੰਮਣ ਦੇ ਲਈ ਆਉਣਾ ਸੀਗਾ ਕੀ ਤੁਸੀਂ ਸਾਨੂੰ ਇੱਥੇ ਮਤਲਬ ਦੱਸ ਸਕਦੇ ਹੋਗੇ ਕੋਈ ਗੁਰਦੁਆਰੇ ਵਗੈਰਾ ਮਤਲਬ ਜਿੱਥੇ ਅਸੀਂ ਘੁੰਮ ਸਕਦੇ ਹੋਈਏ ਕੋਈ ਹੋਰ ਪਲੇਸ ਹੋਵੇ ਜਿੱਥੇ ਘੁੰਮ ਸਕਦੇ ਹੋਈਏ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਓਕੇ ਠੀਕ ਹੈ ਕੋਈ ਹੋਰ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਜਿਹੜੀ ਆਪਣੀ ਆਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਠੀਕ ਹੈ ਮੈਮ ਮਤਲਬ ਉਹ ਵੀ ਹਿਸਟੋਰੀਕਲੀ ਹੀ ਹੈਗਾ ਮਤਲਬ ਉੱਥੇ ਕੁਛ ਹੋਇਆ ਸੀਗਾ ਪਹਿਲੇ ਠੀਕ ਹੈ ਮੈਮ ਮਤਲਬ ਇਹ ਨਾ ਹਾਂਜੀ ਠੀਕ ਹੈ ਮਤਲਬ ਵਿਸਾਖੀ ਨੂੰ ਉੱਥੇ ਮੇਲਾ ਭਰਦਾ ਹੋਏਗਾ ਜਿਵੇਂ ਅਲੱਗ ਜਗ੍ਹਾ 'ਤੇ ਭਰਦਾ ਠੀਕ ਹੈ ਜੀ ਚਲੋ ਮੈਂ ਨਾ ਤੁਹਾਨੂੰ ਜਦੋਂ ਅਸੀਂ ਆਉਣਾ ਹੋਏਗਾ ਤੁਹਾਨੂੰ ਮੈਂ ਕੋਲ ਕਰਾਂਗੀ ਤੁਸੀਂ ਮੈਨ ਮੈਨੂੰ ਹੋਰ ਵੀ ਕੋਈ ਜਾਣਕਾਰੀ ਚਾਹੀਦੀ ਹੋਈ ਜਾਂ ਤੁਹਾਡੀ ਮਦਦ ਤੁਹਾਡੀ ਲੋੜ ਪਈ ਤਾਂ ਤੁਸੀਂ ਮੈਨੂੰ ਜ਼ਰੂਰ ਗਾਈਡ ਕਰਿਓ ਸ਼ੁਕਰੀਆ ਤੁਸੀਂ ਮੈਨੂੰ ਜਾਣਕਾਰੀ ਦਿੱਤੀ ਧੰਨਵਾਦ ਜੀ ਠੀਕ ਹੈ ਜੀ ਓਕ